ਗਾਣਾ ਜੀ ਜੋ ਸੁਣੀਦਾ ਜਾਂ ਜੋ ਸਮਾਂ ਲਈਦਾ ਉਹ ਲਈਦਾ ਸਵੇਰੇ ਜਾਂ ਕੰਮ ਤੋਂ ਵਿਹਲੇ ਹੋ ਕੇ ਇੱਕ ਦੋ ਗਾਣੇ ਉਦੋਂ ਸੁਣ ਲਓ ਸ਼ਾਮੀ ਸੁਣ ਲਓ ਰਾਤੀ ਸੁਣ ਲਓ ਜਦੋਂ ਮਰਜ਼ੀ ਸੁਣ ਲਓ ਗਾਣਿਆਂ ਦਾ ਤਾਂ ਮਜ਼ਾ ਹੀ ਆ ਜਾਂਦਾ ਜੀ ਸੁਣਨ ਦਾ ਬਾਕੀ ਗਾ ਵੀ ਲਈਦੇ ਨੇ ਗਾਣੇ ਜਿਹੜੇ ਨੇ ਉਹ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਨੇ ਇਹ ਤੋਂ ਬਹੁਤ ਕੁਛ ਚੀਜ਼ਾਂ ਸਮਝ ਲੱਗਦੀਆਂ ਅੱਜ ਦੇ ਜਿਹੜੇ ਸਿੰਗਰ ਨੇ ਜਿਹੜੇ ਗੀਤਕਾਰ ਨੇ ਉਹ ਨਵੀਆਂ ਨਵੀਆਂ ਚੀਜ਼ਾਂ ਨਵੇਂ ਨਵੇਂ ਸਾਜ ਨਵੇਂ ਨਵੇਂ ਤਰੀਕੇ ਨਾਲ਼ ਗਾਉਂਦੇ ਅਤੇ ਵਜਾਉਂਦੇ ਨੇ ਗੀਤ ਸਿੱਖਣ ਲਈ ਅੱਜ ਕੱਲ੍ਹ ਬਹੁਤ ਚੀਜ਼ਾਂ ਨੇ ਪਹਿਲਾਂ ਜ਼ਮਾਨੇ 'ਚ ਰੇਡੀਓ ਚੱਲਦਾ ਸੀ ਅੱਜ ਕੱਲ੍ਹ ਫ਼ੋਨ 'ਤੇ ਰੇਡੀਓ ਚੱਲਦਾ ਯੂਟੀਊਬ 'ਤੇ ਸਿੱਖ ਸਕਦੇ ਹੋ ਫੇਸਬੁੱਕ ਤੋਂ ਸਿੱਖ ਸਕਦੇ ਹੋ ਬਾਕੀ ਤੁਹਾਡੇ ਅੱਜ ਅੱਜ ਦੇ ਦੌਰ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਗੱਡੀ 'ਚ ਗਾਣੇ ਚੱਲਦੇ ਨੇ ਘਰ ਗਾਣੇ ਚੱਲਦੇ ਨੇ ਕਿਤੇ ਵਿਆਹ ਸ਼ਾਦੀ 'ਤੇ ਜਾਂਦੇ ਹੋ ਜਿਵੇਂ ਜਿਵੇਂ ਉਹ ਬੋਲਦੇ ਹਨ ਉਵੇਂ ਉਵੇਂ ਪਿੱਛੇ ਪਿੱਛੇ ਬੋਲ ਬੋਲ ਕੇ ਵੀ ਸਿੱਖ ਲੈਂਦੇ ਨੇ ਕਈ ਬਾਕੀ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਵੀ ਨੇ ਜੋ ਗਾਣੇ ਸਿਖਾਉਂਦੀਆਂ ਨੇ ਅਤੇ ਸਾਜ਼ ਵਜਾਉਣਾ ਵੀ ਸਿਖਾਉਂਦੀਆਂ ਨੇ ਲੋਕ ਉੱਥੇ ਵੀ ਬਹੁਤ ਜਾਂਦੇ ਨੇ ਜਿਹਦੇ ਕੋਲ ਟਾਈਮ ਨਹੀਂ ਹੈਗਾ ਉਹ ਆਪਣੇ ਮਨੋਰੰਜਨ ਲਈ ਇਹ ਚੀਜ਼ਾਂ ਘਰ ਹੀ ਕਰ ਲੈਂਦਾ ਹੈ